ਬਚਪਨ ਤੋਂ ਹੀ ਫਿਜੀਕਲ ਐਕਟ ਐਕਟੀਵਿਟੀਸ ਨੂੰ ਮੈਂ ਬਹੁਤ ਲਾਈਕ ਕਰਦਾ ਰਿਹਾ ਮੈਂ ਜਿਸ ਤਰ੍ਹਾਂ ਖੇਡਾਂ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਗੇਮਸ ਅਤੇ ਮੈਨੂੰ ਫਿਜੀਕਲੀ ਕਿਸੇ ਤਰ੍ਹਾਂ ਦੀ ਕੋਈ ਚਾਹੇ ਐਕਸਰਸਾਈਜ਼ ਹੋਣ ਜਿ ਜਿਸ ਤਰ੍ਹਾਂ ਯੋਗਾ ਵਗੈਰਾ ਵੈ ਇਹ ਸਭ ਕਰਕੇ ਬੜਾ ਅੱਛਾ ਲੱਗਦਾ ਸੀ ਔਰ ਮੈਂ ਬੜੇ ਆਰਾਮ ਨਾਲ ਇਸ ਨੂੰ ਕਰ ਵੀ ਪਾਉਂਦਾ ਸੀਗਾ ਅਤੇ ਜਿਉਂ ਮੈਂ ਥੋੜ੍ਹਾ ਅ ਵੱਡਾ ਹੋਇਆ ਅਤੇ ਫਿਰ ਮੈਂ ਮਹਿਸੂਸ ਕੀਤਾ ਕਿ ਮੇਰੇ ਹੈਲਥ ਵਾਸਤੇ ਕੁਝ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਮੈਂ ਕਾਫੀ ਅ ਹੈਲਪਫੁਲ ਹੋ ਸਕਦੀਆਂ ਜਿਨ੍ਹਾਂ ਨੂੰ ਮੈਂ ਸਾਰੀ ਜ਼ਿੰਦਗੀ ਆਪਣੇ ਨਾਲ ਅਪਣਾ ਕੇ ਚੱਲ ਸਕਦਾ ਵੈ ਅਤੇ ਉਹ ਯੋਗਾ ਨੂੰ ਮੈਂ ਫਿਰ ਪ੍ਰੋਪਰਲੀ ਅ ਬੁੱਕਸ ਦੇ ਮਾਧਿਅਮ ਤੋਂ ਜਾਂ ਕੁਛ ਜਾਣਕਾਰਾਂ ਤੋਂ ਇਹਦੇ ਬਾਰੇ ਗਾਈਡੈਂਸ ਲਿੱਤੀ ਅਤੇ ਕੁਛ ਪਰਟੀਕੁਲਰ ਜਿਸ ਤਰ੍ਹਾਂ ਅ ਧਨੂਰ ਆਸਨ ਜਾਂ ਪਦਮ ਆਸਨ ਇਸ ਤਰ੍ਹਾਂ ਦੇ ਕੁਛ ਆਸਨ ਵਗੈਰਾ ਸਿੱਖ ਕੇ ਅਤੇ ਈਵਨ ਪ੍ਰਣਾਯਾਮ ਦੀ ਵੀ ਟ੍ਰੇਨਿੰਗ ਲੈ ਕੇ ਅਤੇ ਮੈਂ ਇਹਦੀ ਪ੍ਰੈਕਟਿਸ ਕਰਦਾ ਰਿਹਾ ਪਹਿਲਾਂ ਮੈਂ ਇਸ ਜਿਸ ਤਰ੍ਹਾਂ ਕਿ ਇੰਨਾ ਫ਼ਰਕ ਮਹਿਸੂਸ ਕਰਦਾ ਕਿ ਜਦੋਂ ਮੈਂ ਪਹਿਲੇ ਫਲੈਕਸੀਬਿਲਟੀ ਹੁੰਦੀ ਸੀ ਤਾਂ ਮੈਂ ਕਾਫੀ ਅ ਮੈਕਸੀਮ ਐਕਸਰਸਿਸ ਕਰ ਪਾਉਂਦਾ ਸੀਗਾ ਔਰ ਸਮੇਂ ਦੇ ਨਾਲ ਇਹ ਹੈ ਕਿ ਯੋਗਾ ਦੀਆਂ ਐਕਸਰਸਾਈਜ਼ ਅਤੇ ਉਹੀ ਰਹੀਆਂ ਵਾ ਲੇਕਿਨ ਉਹਨਾਂ ਨੂੰ ਕਰਨ ਵਿੱਚ ਮੈਨੂੰ ਕਿਉਂਕਿ ਫਰਕ ਪਿਆ ਅਤੇ ਮੈਂ ਕੁਛ ਪਰਟੀਕੁਲਰ ਆਪਣੀ ਏਜ ਵਾਈਜ਼ ਚੀਜ਼ਾਂ ਨੂੰ ਚੁਣ ਲਿਆ ਅਤੇ ਉਹਨਾਂ ਨੂੰ ਹੀ ਕੰਟੀਨਿਊ ਕਰ ਲਈਆਂ ਮੈਂ ਜਿਹੜੀਆਂ ਕਿ ਮੇਰੇ ਕੋਲ ਆਪਣੀ ਅ ਸਰੀਰ ਮੇਰਾ ਉਹਨੂੰ ਘਰ ਪਾ ਗਿਆ ਬਾਕੀ ਜਿਹੜੀਆਂ ਹੈਵੀ ਐਕਸਰਸਾਈਜ਼ ਜਾਂ ਹੈਵੀ ਯੋਗਾ ਦੀਆਂ ਜਿਹੜੀਆਂ ਹੁੰਦੀਆਂ ਐਕਟੀਵਿਟੀਜ਼ ਉਹ ਨਹੀਂ ਮੈਂ ਕਰ ਪਾਉਂਦਾ ਬਾਕੀ ਇਹਦੇ ਕਰਕੇ ਮੈਨੂੰ ਆਪਣੀ ਬੜਾ ਮਦਦ ਮਿਲੀ ਹੈ ਮੈਂ ਆਪਣੀ ਹੈਲਥ ਨੂੰ ਅੱਜ ਤੱਕ ਮੈਂਟੇਨ ਕਰਕੇ ਚੱਲ ਰਿਹਾ ਵੈਂ